ਮੇਰੇ ਕੋਲ ਕੋਈ ਵੀ ਮਨਪਸੰਦ ਕਿਤਾਬ ਨਹੀਂ ਹੈ ਪੜ੍ਹਨਾ ਮੇਰਾ ਸ਼ੌਂਕ ਹੈ ਪਰ ਕਿਤਾਬਾਂ ਨਾਲੋਂ ਜ਼ਿਆਦਾ ਮੈਨੂੰ ਅਖਬਾਰ ਪੜ੍ਹਨਾ ਪਸੰਦ ਹੈ ਸਾਡੇ ਘਰ ਅਲੱਗ ਅਲੱਗ ਤਰ੍ਹਾਂ ਦੇ ਅਖਬਾਰ ਆਉਂਦੇ ਨੇ ਦਾ ਟ੍ਰਿਬਿਊਨ ਜਗ ਬਾਣੀ ਪੰਜਾਬ ਕੇਸਰੀ ਦੈਨਿਕ ਭਾਸਕਰ ਇਹਨਾਂ 'ਚੋਂ ਮੈਨੂੰ ਸਭ ਤੋਂ ਵੱਧ ਵਧੀਆ ਦੈਨਿਕ ਭਾਸਕਰ ਅਖਬਾਰ ਲੱਗਦਾ ਹੈ ਕਿਉਂਕਿ ਇਸ ਵਿੱਚ ਦੇਸ਼ ਵਿਦੇਸ਼ ਤੋਂ ਇਲਾਵਾ ਸਾਡੇ ਇਲਾਕੇ ਦੀਆਂ ਸਾਰੀਆਂ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਖਬਰ ਛਪੀ ਹੁੰਦੀ ਹੈ ਇਸ ਅਖਬਾਰ ਵਿੱਚ ਰੋਜ਼ ਸੂ ਵਿਚਾਰ ਆਉਂਦੇ ਹਨ ਓਹ ਮੈਨੂੰ ਬਹੁਤ ਚੰਗੇ ਲੱਗਦੇ ਨੇ ਇਸ ਵਿੱਚ ਬਿਜ਼ਨਸ ਭਾਸਕਰ ਨਾਂ ਦਾ ਪੇਜ ਹੁੰਦਾ ਹੈ ਜਿਸ ਤੋਂ ਸਾਨੂੰ ਬਿਜ਼ਨਸ ਦੀ ਅਪਸ ਅਤੇ ਡਾਊਨ ਦਾ ਪਤਾ ਲੱਗਦਾ ਹੈ ਸ਼ੇਅਰ ਮਾਰਕੀਟ ਬਾਰੇ ਜਾਣਕਾਰੀ ਮਿਲਦੀ ਹੈ ਇਸ ਵਿੱਚ ਐਜੂਕੇਸ਼ਨ ਭਾਸਕਰ ਦੇ ਅਧੀਨ ਭਾਸਕਰ ਪ੍ਰਸ਼ਨ ਬੈਂਕ ਰਾਹੀਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਇਸ ਵਿੱਚ ਹਾਸ ਰੰਗ ਨਾਂ ਦਾ ਵੀ ਪੇਜ ਹੁੰਦਾ ਹੈ ਜੋ ਕਿ ਵਧੀਆ ਪੇਜ ਹੁੰਦਾ ਹੈ ਗਲੈਮਰ ਵਾਲੇ ਪੇਜ ਤੋਂ ਸਾਨੂੰ ਫਿਲਮ ਇੰਡਸਟਰੀ ਦੀਆਂ ਸਾਰੀਆਂ ਖਬਰਾਂ ਪਤਾ ਲੱਗਦੀਆਂ ਹਨ ਕਦੋਂ ਕਿਸ ਫਿਲਮ ਨੇ ਰਿਲੀਜ਼ ਹੋਣਾ ਹੈ ਕੀ ਲੇਟੈਸਟ ਫੈਸ਼ਨ ਚੱਲ ਰਿਹਾ ਹੈ ਇੱਕ ਪੇਜ ਸਪੋਰਟਸ ਦਾ ਹੁੰਦਾ ਹੈ ਜਿਸ ਤੋਂ ਸਾਨੂੰ ਸਪੋਰਟਸ ਦੇ ਸਾਰੇ ਅਪਡੇਟਸ ਪਤਾ ਲੱਗਦੇ ਹਨ ਦੇਸ਼ ਵਿਦੇਸ਼ ਨਾਂ ਦੇ ਪੇਜ਼ ਤੋਂ ਸਾਨੂੰ ਸਾਰੇ ਦੇਸ਼ਾਂ ਦੀਆਂ ਖਬਰਾਂ ਪਤਾ ਲੱਗਦੀਆਂ ਹਨ ਇਸ ਅਖਬਾਰ ਵਿੱਚ ਵਰਚੁਨਿਟੀ ਅਪਡੇਟਸ ਵੀ ਮਿਲਦੀਆਂ ਹਨ ਸਿਹਤ ਦਾ ਖਿਆਲ ਰੱਖਣ ਲਈ ਵੱਖ ਵੱਖ ਮਾਹਰਾਂ ਦੁਆਰਾ ਕਸਰਤ ਦੇ ਤਰੀਕੇ ਦੱਸੇ ਜਾਂਦੇ ਹਨ ਖਾਣਾ ਬਣਾਉਣ ਦੀਆਂ ਰੈਸਪੀਆਂਜ਼ ਵੀ ਇਸ ਵਿੱਚ ਦੱਸੀਆਂ ਜਾਂਦੀਆਂ ਹਨ ਇਸ ਅਖਬਾਰ ਵਿੱਚ ਰਾਜਨੀਤੀ ਉੱਤੇ ਵੀ ਵਧੀਆ ਆਰਟੀਕਲ ਛਪਦੇ ਹਨ ਇਸ ਅਖਬਾਰ ਤੋਂ ਹਰ ਪ੍ਰਕਾਰ ਦੀ ਭਰਪੂਰ ਜਾਣਕਾਰੀ ਮਿਲਦੀ ਹੈ ਇਸ ਲਈ ਮੈਨੂੰ ਇਹ ਅਖਬਾਰ ਪੜ੍ਹਨਾ ਬਹੁਤ ਪਸੰਦ ਹੈ ਮੈਨੂੰ ਸਵੇਰੇ ਇਸਦੀ ਉਡੀਕ ਰਹਿੰਦੀ ਹੈ